ਪੰਜਾਬੀ ਭਾਸ਼ਾ ਦਾ ਇਤਿਹਾਸ ਇਵੇਂ ਹੈ ਵੀ ਪੰਜਾਬੀ ਭਾਸ਼ਾ ਤਕਰੀਬਨ ਬਹੁਤ ਮਿੱਠੀ ਭਾਸ਼ਾ ਆ ਪੰਜ ਸੱਤ ਸੌ ਸਾਲ ਤੋਂ ਵੀ ਪਹਿਲਾਂ ਇਹ ਭਾਸ਼ਾ ਚਲਦੀ ਆ ਰਹੀ ਹੈ ਜਿੱਦਾਂ ਪੰਜਾਬ ਸਟੇਟ ਦੇ ਵਿੱਚ ਇਹਦੇ ਨਾਲ ਲੱਗਦਾ ਪਾਕਿਸਤਾਨ ਦੀ ਪੰਜਾਬ ਸਟੇਟ ਆ ਉੱਥੇ ਵੀ ਬੋਲੀ ਜਾਂਦੀ ਹੈ ਇਹ ਵਿਕਸਿਤ ਜਿਹੜੀ ਹੈ ਇਹ ਗੁਰਮੁਖੀ ਦੇ ਨਾਲ ਹੋਈ ਹੈ ਗੁਰਮੁਖੀ ਲਿਪੀ ਜੋ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਜੋ ਇਹ ਸ਼ੁਰੂਆਤ ਹੋਈ ਹੈ ਧੰਨਵਾਦ